ਬਿਜਲੀ ਦੇ ਕੱਟ ਲਗਾਉਣ ਜਿਵੇਂ ਕਿ ਬਹੁਤ ਜਿਆਦਾ ਗਰਮੀ ਹੁੰਦੀ ਹੈ ਅਤੇ ਅੱਜ ਦੇ ਟਾਈਮ ਵਿੱਚ ਬਿਜਲੀ ਤੋਂ ਰਹਿਣ ਬਿਜਲੀ ਤੋਂ ਬਿਨਾਂ ਰਹਿਣਾ ਬਹੁਤ ਹੀ ਔਖਾ ਹੁੰਦਾ ਹੈ ਅਤੇ ਅੱਜ ਕੱਲ੍ਹ ਘਰਾਂ ਵਿੱਚ ਸਾਰਿਆਂ ਦੇ ਘਰਾਂ ਵਿੱਚ ਇਨਵੇਟਰ ਵੀ ਹੈ ਜਿਸ ਕਰਕੇ ਬਿਜਲੀ ਦਾ ਐਨਾ ਪਤਾ ਨੀ ਲੱਗਦਾ ਹੈਗਾ ਅਤੇ ਗਰਮੀਆਂ ਵਿੱਚ ਤਾਂ ਬਹੁਤ ਜ਼ਿਆਦਾ ਕੱਟ ਲੱਗਣ ਕਾਰਨ ਅਤੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਹਿਲੇ ਦਾ ਸਮਾਂ ਸੀ ਜਦੋਂ ਬਿਜਲੀ ਜਾਂਦੀ ਸੀ ਅਤੇ ਦੀਵੇ ਬਾਲ਼ ਕੇ ਰੋਟੀ ਖਾਈ ਜਾਂਦੀ ਸੀ ਅਤੇ ਸਰ੍ਹੋਂ ਦੇ ਤੇਲ ਦੇ ਦੀਵੇ ਬਾਲ਼ ਕੇ ਰੋਟੀ ਖਾਈ ਜਾਂਦੀ ਸੀ ਅਤੇ ਰੋਜੀ ਰੋਟੀ ਬਿਜਲੀ ਦੇਣ 'ਤੇ ਨਿਰਭਰ ਨਹੀਂ ਹੈ ਜਦੋਂ ਬਿਜਲੀ ਅੱਜ ਕੱਲ੍ਹ ਦੇ ਟਾਈਮ 'ਚ ਬਿਜਲੀ ਦਾ ਹੋਣਾ ਜ਼ਰੂਰੀ ਹੈ ਬਿਜਲੀ ਤੋਂ ਬਿਨਾਂ ਪਾਣੀ ਵੀ ਨਹੀਂ ਹੈ ਅਤੇ ਜਦੋਂ ਬਿਜਲੀ ਆਉਂਦੀ ਹੈ ਤਾਂ ਮੋਟਰ ਵਗੈਰਾ ਵੀ ਲਗਾਈ ਜਾਂਦੀ ਹੈ ਉਹਦੇ ਨਾਲ ਪਾਣੀ ਦਾ ਵੀ ਪ੍ਰਬੰਧ ਰਹਿੰਦਾ ਹੈ ਅਤੇ ਲਾਈਟ ਦਾ ਵੀ ਹਾਂਜੀ ਪਹਿਲਾਂ ਇਨਵੇਟਰ ਹੋਣ ਕਰਕੇ ਬਿਜਲੀ ਦੇ ਜਿਆਦਾ ਸਾਨੂੰ ਦਾ ਸਾਹਮਣਾ ਨਹੀਂ ਕਰਨਾ ਪੈਂਦਾ